ਹੈਲੋ ਹੈਲੋ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਕਲਚਰਲ ਡਿਪਾਰਟਮੈਂਟ ਤੋਂ ਬੋਲ ਰਹੇ ਹੋ ਜੀ ਮਿਮਟ ਕਾਲਜ ਮਲੋਟ ਤੋਂ ਜੀ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਫਿਰ ਤੋਂ ਜੀ ਅਤੇ ਮੈਮ ਮੈਂ ਨਾ ਤੁਹਾਡੇ ਕੋਲਜ ਯੂਥ ਫੈਸਟੀਵਲ 'ਤੇ ਆਪਣੇ ਕੁੜੀਆਂ ਦੀ ਗਿੱਧੇ ਦੀ ਟੀਮ ਐਂਟਰ ਕਰਵਾਉਣੀ ਸੀਗੀ ਅਤੇ ਮੈਮ ਮੈਂ ਇਹ ਪੁੱਛਣਾ ਸੀਗਾ ਵੀ ਉਹਨਾਂ ਦੇ ਜੋ ਗਿੱਧੇ ਦੇ ਵਿੱਚ ਉਹਨਾਂ ਨੂੰ ਤਿਆਰ ਹੋਣ ਲਈ ਜੋ ਚਾਹੀਦੇ ਹੁੰਦੇ ਫਰੋਪਸ ਚਾਹੀਦੇ ਹੁੰਦੇ ਆ ਜੀ ਠੀਕ ਹੈ ਜੀ ਹਾਂਜੀ ਡਰੈਸਿੰਗ ਕੋਡ ਦੱਸੋ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਮ ਠੀਕ ਹੈ ਜੀ ਮੈਮ ਠੀਕ ਹੈ ਮੈਮ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਮ ਠੀਕ ਹੈ ਜੀ ਅਤੇ ਮ ਹੋਰ ਕੁਛ ਵੀ ਜੋ ਮੈਨੂੰ ਦੱਸ ਦਿਓ ਮੈਮ ਕਿਉਂਕਿ ਇੱਦਾਂ ਨਾ ਵੀ ਮੈਂ ਫਿਰ ਕੁੜੀਆਂ ਨੂੰ ਪਹਿਲਾਂ ਹੀ ਕਹਿ ਦੂੰਗਾ ਵੀ ਹੈ ਨਾ ਵੀ ਆਹਾ ਆਹਾ ਕੁਛ ਆਪਾਂ ਨੂੰ ਚਾਹੀਦਾ ਵੀ ਆਹ ਤੁਹਾਡੇ ਜ਼ਰੂਰੀ ਚੀਜ਼ਾਂ ਅਤੇ ਇਹਨਾਂ ਨੂੰ ਨਾਲ ਲੈ ਕੇ ਜਾਓ ਕਿਉਂਕਿ ਮੈਮ ਫਿਰ ਯੂਥ ਫੈਸਟੀਵਲ ਦੇ ਟਾਈਮ 'ਤੇ ਮੌਕੇ 'ਤੇ ਇਹ ਚੀਜ਼ਾਂ ਨਹੀਂ ਮਿਲਦੀਆਂ ਜੀ ਫਿਰ ਟੀਮ ਨੂੰ ਨਾ ਜੀ ਡਿਸਕੋਲੀਫਾਈ ਕਰ ਦਿੰਦੇ ਆ ਮੈਂ ਤਾਂ ਕਰਕੇ ਤੁਹਾਨੂੰ ਪਹਿਲਾਂ ਹੀ ਫੋਨ ਕੀਤਾ ਮੈਂ ਵੀ ਚਲੋ ਮੈਂ ਤੁਹਾਡੇ ਤੋਂ ਪਹਿਲਾਂ ਸਾਰੀ ਇਨਫੋਰਮੇਸ਼ਨ ਲੈ ਲਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਮੈਮ ਜ਼ਰੂਰ ਜੀ ਓਕੇ ਮੈਮ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ